ਸਤਿ ਸ਼੍ਰੀ ਅਕਾਲ ਜੀ ਸੋ ਮੈਂ ਆਪਣੇ ਜਨਮ ਦਿਨ 'ਤੇ ਇੱਕ ਘੜੀ ਮੰਗਵਾਈ ਸੀ ਤੋਹਫੇ ਵਜੋਂ ਉਹ ਮੇਰੇ ਕੋਲ ਪਹੁੰਚੀ ਨਹੀਂ ਹੈ ਉਸ ਨੂੰ ਕਿੰਨਾ ਟੈਮ ਲੱਗੇਗਾ ਮੇਰੇ ਕੋਲ ਪਹੁੰਚਣ ਵਾਸਤੇ ਸੋ ਕਿਰਪਾ ਕਰਕੇ ਉਹ ਮੈਨੂੰ ਦੱਸਿਆ ਜਾਵੇ ਉਸ ਦੀ ਮੇਰੇ ਕੋਲ ਪੁਸ਼ਟੀ ਕੀਤੀ ਜਾਵੇ ਧੰਨਵਾਦ ਜੀ